ਹੈਲੋ ਓਲਾ ਤੋਂ ਬੋਲਦੇ ਪਏ ਜੇ ਭਾਅ ਜੀ ਮੈਂ ਤੁਹਾਡੀ ਕੈਬ ਬੁੱਕ ਕਰਵਾਈ ਸੀਗੀ ਅਤੇ ਮੈਂ ਤੁਹਾਨੂੰ ਇਹ ਦੱਸਣਾ ਸੀਗਾ ਕਿ ਸਾਡੀ ਜਿਹੜੀ ਅਸੀਂ ਮੌਜੂਦਾ ਜਗ੍ਹਾ ਜਿੱਥੇ ਰਹਿੰਦੇ ਹਾਂ ਅਸੀਂ ਉਹ ਉੱਥੋਂ ਨਿਕਲ ਚੁੱਕੇ ਹਾਂ ਅਤੇ ਹੁਣ ਅਸੀਂ ਦੋ ਕਿਲੋਮੀਟਰ ਤੇ ਦੂਰੀ 'ਤੇ ਆ ਖੈਰਦੀ ਖੈਰਦੀ ਰੁਕੇ ਹੋਏ ਹਾਂ ਅਤੇ ਮੈਂ ਤੁਹਾਡੇ ਡਰਾਈਵਰ ਨੂੰ ਇਹ ਕਹਿਣਾ ਸੀਗਾ ਕਿ ਤੁਸੀਂ ਉਹਨਾਂ ਨੂੰ ਬੋਲੋ ਕਿ ਅਸੀਂ ਖੈਰਦੀ ਰੁਕੇ ਹੋਏ ਹਾਂ ਅਤੇ ਉੱਥੋਂ ਸਾਨੂੰ ਆ ਕੇ ਅਤੇ ਪਿੱਕ ਕਰ ਲੈਣ ਅਤੇ ਪਲੀਜ਼ ਉਹਨਾਂ ਨੂੰ ਜਿਹੜਾ ਜਲਦੀ ਭੇਜਿਓ ਅ ਫਿਰ ਅਸੀਂ ਲੇਟ ਹੋ ਜਾਣਾ ਆ ਐਸੀ ਜਗ੍ਹਾ ਵੀ ਫਿਰ ਬਹੁਤ ਸਾਰੀਆਂ ਜਗ੍ਹਾ ਜਾਣਾ ਆ ਇਹ ਰੋਜ਼ ਗਾਰਡਨ ਜਾਣਾ ਵਾ ਸੁਖਣਾ ਝੀਲ ਜਾਣਾ ਆ ਅਤੇ ਹੋਰ ਵੀ ਸਾਰਾ ਚੰਡੀਗੜ੍ਹ ਘੁੰਮਣਾ ਆ ਫਿਰ ਸ਼ੋਪਿੰਗ ਵੀ ਕਰਨੀ ਆ ਅਤੇ ਫਿਰ ਤੁਸੀਂ ਫਿਰ ਸਾਨੂੰ ਬਹੁਤ ਟਾਈਮ ਲੱਗ ਜਾਣਾ ਆ ਅਤੇ ਤੁਸੀਂ ਇਹ ਥੋੜ੍ਹਾ ਜਿਹਾ ਜਲਦੀ ਨਾਲ ਉਹਨਾਂ ਨੂੰ ਵੀ ਭੇਜ ਦਿਓ ਅਤੇ ਉਹਨਾਂ ਨੂੰ ਜ ਇਹ ਦੱਸ ਦਿਓ ਕਿ ਅਸੀਂ ਖੈਰਦੀ ਰੁਕੇ ਹੋਏ ਹਾਂ ਅਤੇ ਉੱਥੋਂ ਸਾਨੂੰ ਆ ਕੇ ਪਿੱਕ ਕਰ ਲੈਣ